ਹਾਂਜੀ ਗੁਰਜੀਤ ਮੈਂ ਨਾ ਡਾਕਟਰ ਅਮਨ ਕੋਲ ਗਈ ਸੀਗੀ ਬਠਿੰਡੇ ਹੈਲਥ ਐਂਡ ਵੈਲਥ ਪਤਾ ਏ ਨਾ ਤੁਹਾਨੂੰ ਅਤੇ ਉਹਨਾਂ ਨੇ ਕਿਹਾ ਬਈ ਵੇਟ ਗੇਨ ਕਰਨ ਵਾਸਤੇ ਨਾ ਕੁਛ ਵਧੀਆ ਨਿਊਟਰੇਸ਼ਨ ਪ੍ਰੋਟੀਨ ਵਗੈਰਾ ਲੈਣਾ ਪਊਗਾ ਤੁਹਾਨੂੰ ਅਤੇ ਉਹਦੇ ਅਕੋਰਡਿੰਗ ਮੈਂ ਇਹ ਤਾਂ ਪੁੱਛ ਲਿਆ ਸੀ ਬਈ ਕੀ ਖਾਇਆ ਜਾਵੇ ਕੀ ਨਹੀਂ ਖਾਇਆ ਜਾਵੇ ਅਤੇ ਹੁਣ ਮੈਂ ਸੋਚਦੀ ਹਾਂ ਬਈ ਤੁਸੀਂ ਘਰੇ ਆ ਗਏ ਆ ਪਹਿਲਾਂ ਤਾਂ ਅੱਛਾ ਅੱਛਾ ਠੀਕ ਹੈ ਜੀ ਅਤੇ ਪਨੀਰ ਦੇ ਦੁੱਧ ਦਾ ਕੱਢ ਕੇ ਰੱਖ ਲਈ ਮੈਂ ਸ਼ਾਮ ਨੂੰ ਦੁੱਧ ਨਾਲ ਹੀ ਲਊਂਗੀ ਦੁੱਧ ਤਾਂ ਆਇਆ ਹੋਊਗਾ ਸਵੇਰੇ ਹੀ ਆ ਜਾਂਦਾ ਹੁੰਦਾ ਅਤੇ ਦੁੱਧ ਦਾ ਇਕ ਕਿਲੋ ਵਾਲਾ ਕੱਢ ਕੇ ਨਾ ਪਨੀਰ ਅਤੇ ਅੱਧਾ ਕਿਲੋ ਮੇਰੇ ਵਾਸਤੇ ਬਚਾ ਕੇ ਰੱਖ ਲਈਂ ਨਹੀਂ ਉਹਨਾਂ ਨੇ ਤਾਂ ਕਿਹਾ ਵੀ ਜਿਹੜਾ ਵੀ ਤੁਹਾ ਤੁਹਾਡਾ ਮਨ ਹੈ ਨਾ ਉਹੀ ਫੇਰ ਰੱਖ ਲਓ ਉਹਨਾਂ ਨੇ ਦੋਨੇਂ ਲਿਸਟਾਂ ਭੇਜ ਦਿੱਤੀਆਂ ਨਾਨ ਵੈਜ ਦੀਆਂ ਵੀ ਅਤੇ ਵੈਜ ਦੀਆਂ ਵੀ ਹਾਂ ਉਹ ਜਿਹੜੀ ਲਿਸਟ ਡਾਕਟਰ ਅਮਨ ਨੇ ਭੇਜੀ ਹੈ ਨਾ ਮੈਨੂੰ ਉਹ ਮੈਂ ਤੁਹਾਨੂੰ ਵਟਸਐਪ ਕਰਤੀ ਹੈ ਅਤੇ ਉਹਦੇ ਅਕੋਰਡਿੰਗ ਨਾ ਹੁਣ ਸ਼ਾਮ ਦੀ ਮੀਲ ਰੈਡੀ ਕਰਕੇ ਰੱਖ ਦਿਓ ਬਸ ਮੈਂ ਅੱਧੇ ਕੁ ਘੰਟੇ ਤੱਕ ਨਾ ਆਉਂਦੀ ਹਾਂ ਮੈਂ ਠੀਕ ਹੈ ਅਤੇ ਘਰੇ ਕੀ ਕੁਝ ਨਹੀਂ ਹੈਗਾ ਨਿਊਟਰੀਸ਼ਨ ਪ੍ਰੋਟੀਨ ਵਾਸਤੇ ਉਹ ਮੈਨੂੰ ਦੱਸ ਦਿਓ ਮੈਂ ਲਿਸਟ ਬਣਾ ਲੈਂਦੀ ਹਾਂ ਫਿਰ ਮੈਂ ਆਉਂਦੀ ਹੋਈ ਲੈ ਆਊਂਗੀ ਠੀਕ ਹੈ ਜੀ ਹੋਰ ਠੀਕ ਹੈ ਠੀਕ ਹੈ ਐਪਲ ਬਨਾਨਾ ਅਤੇ ਨਾ ਰਾਤ ਦੀ ਮੀਲ ਮੇਰੀ ਨਾ ਇੱਕ ਰੋਟੀ ਰੱਖਿਓ ਠੀਕ ਹੈ ਇੱਕ ਰੋਟੀ ਮੇਰੀ ਅਤੇ ਦੋ ਰੋਟੀ ਇਹਨਾਂ ਦੀਆਂ ਹਾਂਜੀ ਅਤੇ ਇਹਨਾਂ ਨੇ ਵੀ ਆਪਦਾ ਡਾਇਟ ਪਲਾਨ ਬਣਵਾਇਆ ਇਹਨਾਂ ਦਾ ਫੋਨ ਆਇਆ ਸੀ ਤੁਹਾਨੂੰ ਹਾਂ ਮੈਂ ਇਹਨਾਂ ਨੂੰ ਕਿਹਾ ਸੀਗਾ ਬਈ ਫੋਨ ਕਰ ਲਿਓ ਬਣਾ ਦਊਗੀ ਗੁਰਜੀਤ ਤਾਂ ਮੈਂ ਤੁਹਾਨੂੰ ਇਹ ਕਹਿੰਦੀ ਸੀ ਬਈ ਇੱਕ ਦੋ ਦਿਨ ਨਾ ਸਾਡੇ ਘਰੇ ਰੁਕ ਜੀਓ ਹਾਂ ਕਿਉਂਕਿ ਦੋ ਤਿੰਨ ਦਿਨ ਨਾ ਕੰਟੀਨਿਊਸ ਡਾਇਟ ਲੈਣੀ ਹੈ ਇੱਕ ਵਾਰੀ ਫੁੱਲ ਮਤਲਬ ਪਾਰਟ ਟਾਈਮ ਮਤਲਬ ਫੁੱਲੀ ਹਰ ਸਮਾਨ ਠੀਕ ਹੈ ਅਤੇ ਤੂੰ ਕੁਝ ਖਾਣਾ ਤੇਰੇ ਵਾਸਤੇ ਲੈ ਕੇ ਆਵਾਂ ਚੱਲ ਮੈਂ ਐਂਉਂ ਕਰੂ ਠੀਕ ਹੈ ਮੈਂ ਕਰੂੰਗੀ ਫਿਰ ਬੱਚਿਆਂ ਵਾਸਤੇ ਵੀ ਲੈ ਆਊਂਗੀ ਤੇਰੇ ਬੱਚਿਆਂ ਵਾਸਤੇ ਉਹਨਾਂ ਨੂੰ ਸ਼ਾਮ ਨੂੰ ਬੁਲਾ ਲਈ ਚੰਗਾ ਹਾਂ ਤੈਨੂੰ ਪਤਾ ਤਾਂ ਹੈ ਮੇਰੇ ਬੱਚੇ ਹੈ ਨਹੀਂ ਹੈਗੇ ਫਿਰ ਮੈਂ ਤੇਰੇ ਬੱਚਿਆਂ ਨਾਲ ਹੀ ਖੇਡ ਲੈਂਦੀ ਹੁੰਦੀ ਹਾਂ ਨਹੀਂ ਮੈਂ ਹਾਂ ਨਹੀਂ ਆਪਾਂ ਐਂਉਂ ਕਰਾਂਗੇ ਨਾ ਵੀ ਜੂਸ ਬਾਹਰੋਂ ਤਾਂ ਰੀਅਲ ਰੂਲ ਵਾਲੇ ਤਾਂ ਨਹੀਂ ਲੈ ਕੇ ਆਉਂਦੇ ਆਪਾਂ ਆਹ ਵਧੀਆ ਨਹੀਂ ਹੁੰਦੇ ਹੈਗੇ ਆ ਮੈਂ ਯੂਟੀਊਬ 'ਤੇ ਵੀਡੀਓਜ਼ ਵਗੈਰਾ ਦੇਖੀਆਂ ਸੀਗੀਆਂ ਬਹੁਤ ਗੰਦ ਜਿਹਾ ਪਾਉਂਦੇ ਆ ਯਰੀ ਆਹ ਰੀਅਲ ਜੂਸ 'ਚ ਹੋਰ ਸਲਾਈਸ ਸੂਲਈਸ 'ਚ ਐਹ ਵਧੀਆ ਨਹੀਂ ਹੁੰਦੇ ਹੈਗੇ ਅਤੇ ਆਪਾਂ ਆਈਂ ਕਰਾਂਗੇ ਵੀ ਘਰੇ ਕੱਢ ਕੇ ਪੀ ਲਿਆ ਕਰਾਂਗੇ ਇੱਕ ਗੱਲ ਹਾਂ ਹਾਂ ਉਹ ਤਾਂ ਬਣਦੀ ਹੈ ਜਮ੍ਹਾ ਹੀ ਬੰਦ ਕਰ ਤਾ ਤੈਨੂੰ ਪਤਾ ਮੇਰਾ ਕਿੰਨਾ ਫੇਵਰੇਟ ਹੁੰਦਾ ਸੀਗਾ ਹੈ ਨਾ ਅਤੇ ਹੁਣ ਉਹਨਾਂ ਨੇ ਜਮ੍ਹਾ ਹੀ ਬੰਦ ਕਰਤਾ ਕਹਿੰਦੇ ਬਾਹਰ ਕੁਝ ਸਮਾਨ ਨਹੀਂ ਖਾਣਾ ਹੈਗਾ ਤੁਸੀਂ ਅਤੇ ਬਸ ਉਹਨਾਂ ਨੇ ਠੀਕ ਹੈ ਓਕੇ ਚਲੋ ਮੈਂ ਆਉਂਦੀ ਆ ਫਿਰ ਅੱਧੇ ਘੰਟੇ ਤੱਕ ਓਕੇ ਓਕੇ ਠੀਕ ਹੈ ਓਕੇ ਬਾਏ